ਹਾਂਜੀ ਜੇਕਰ ਆਪਾਂ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਤਾਂ ਇਸ ਭਾਸ਼ਾ ਲਈ ਅੱਜ ਦੇ ਟਮੇ ਸਮੇਂ ਵਿੱਚ ਬਹੁਤ ਸਾਰੀਆਂ ਗਲਤ ਧਾਰਨਾਵਾਂ ਬਣ ਚੁੱਕੀਆਂ ਹਨ ਜਿਵੇਂ ਕਿ ਲੋਕਾਂ ਦਾ ਇਹ ਕਹਿਣਾ ਏ ਕਿ ਪੰਜਾਬੀ ਭਾਸ਼ਾ ਜੋ ਲੋਕ ਬੋਲਦੇ ਹਨ ਉਹ ਬਹੁਤ ਸਾਰੀਆਂ ਗਾਲ਼ਾਂ ਦੀ ਵਰਤੋਂ ਕਰਦੇ ਹਨ ਅਤੇ ਕੁਝ ਵਰਗ ਦੇ ਲੋਕ ਪੰਜਾਬੀ ਭਾਸ਼ਾ ਬੋਲਣ ਵਾਲੇ ਨੂੰ ਮਾੜਾ ਸਮਝਦੇ ਹਨ ਜਦ ਕਿ ਹੈ ਇਸ ਦੇ ਉਲਟ ਇਹ ਬਹੁਤ ਹੀ ਮਿੱਠੀ ਭਾਸਾ ਭਾਸ਼ਾ ਹੈ ਅਤੇ ਇਸਦੀ ਮਿਠਾਸ ਆਪਾਂ ਬੋਲਣ ਵਾਲੇ ਅਤੇ ਜੋ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਲੋਕ ਹਨ ਉਹਨਾਂ ਵਿੱਚ ਅਕਸਰ ਹੀ ਦੇਖ ਸਕਦੇ ਹਾਂ ਪੰਜਾਬੀ ਭਾਸ਼ਾ ਬਹੁਤ ਹੀ ਇੱਕ ਮਿੱਠੀ ਅਤੇ ਬਹੁਤ ਹੀ ਸਾਰਥਕ ਭਾਸ਼ਾ ਹੈ ਇਸ ਭਾਸ਼ਾ ਲਈ ਜੋ ਵੀ ਧਾਰਨਾਵਾਂ ਸਮਾਜ ਵਿੱਚ ਬਣੀਆਂ ਹਨ ਇਹ ਭਾਸ਼ਾ ਉਹਨਾਂ ਦੇ ਬਿਲਕੁਲ ਉਲਟ ਉਲਟ ਹੈ ਅਤੇ ਇਹ ਭਾਸ਼ਾ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਅਤੇ ਹਰ ਇੱਕ ਵਰਗ ਲਈ ਬਹੁਤ ਹੀ ਵਧੀਆ ਅੱਜ ਦੇ ਸਮੇਂ ਵਿੱਚ ਪੇਸ਼ ਹੋਈ ਹੈ ਅਤੇ ਜੇਕਰ ਇਸ ਭਾਸ਼ਾ ਦੇ ਆਪਾਂ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਅੱਜ ਤੋਂ ਪੰਜ ਛੇ ਸੌ ਸਾਲ ਪੁਰਾਣੀ ਭਾਸ਼ਾ ਹੈ ਪਰ ਜਿੰਨਾ ਵਿਕਾਸ ਇਸ ਭਾਸ਼ਾ ਨੇ ਪੰਜ ਛੇ ਸੌ ਸਾਲ ਵਿੱਚ ਕੀਤਾ ਹੈ ਸ਼ਾਇਦ ਹੋਰ ਕਿਸੇ ਵੀ ਭਾਸ਼ਾ ਨੇ ਇੰਨਾ ਵਿਕਾਸ ਨਹੀਂ ਕੀਤਾ ਇਸ ਦੇ ਵਿਰੁੱਧ ਜੋ ਵੀ ਗਲਤ ਧਾਰਨਾਵਾਂ ਬਣੀਆਂ ਹੋਈਆਂ ਹਨ ਉਨ੍ਹਾਂ ਧਾਰਨਾਵਾਂ ਦਾ ਸਾਨੂੰ ਬਾਈਕਾਟ ਕਰਨਾ ਚਾਹੀਦਾ ਹੈ ਅਤੇ ਸਾਨੂੰ ਆਪਣੀ ਭਾਸ਼ਾ ਦੀ ਮਿਠਾਸ ਨੂੰ ਲੋਕਾਂ ਵਿੱਚ ਲੈ ਕੇ ਜਾਣਾ ਚਾਹੀਦਾ ਹੈ ਤਾਂ ਜੋ ਲੋਕ ਇਸ ਭਾਸ਼ਾ ਦੇ ਵਿਰੁੱਧ ਹਨ ਉਹ ਇਸ ਭਾਸ਼ਾ ਦੀ ਮਿਠਾਸ ਨੂੰ ਸਮਝ ਕੇ ਇਸ ਨੂੰ ਬੋਲਣ